ਹਾਂਜੀ ਓਕੇ ਮੈਮ ਕਿਹੜੀ ਵਾਲੀ ਅ ਕਿਹੜੀ ਤੁਸੀਂ ਖਾਈ ਹੈ ਚੀਜ਼ ਕਿਹਦੇ ਤੋਂ ਆ ਰਹੀ ਹੈ ਅਸੀਂ ਤਾਂ ਬਹੁਤ ਵਧੀਆ ਕੁਆਲਟੀ ਦਾ ਵਰਤਦੇ ਹਾਂ ਤੇਲ ਰਿਫਾਇੰਡ ਦਾ ਓਕੇ ਅਸੀਂ ਅਗਾਂਹ ਤੋਂ ਵਧੀਆ ਸਫ਼ਾਈ ਰੱਖਾਂਗੇ ਤੁਸੀਂ ਦੱਸ ਦਿਓ ਨਾ ਕਿਹੜਾ ਮਤਲਬ ਤੁਹਾਨੂੰ ਵਧੀਆ ਲੱਗਦਾ ਆਪਾਂ ਤੇਲ ਉਹ ਹੀ ਵਰਤ ਲਵਾਂਗੇ ਅੱਗੇ ਤੋਂ ਠੀਕ ਹੈ ਮੈਮ ਸਫ਼ਾਈ ਤਾਂ ਰੈਗੂਲਰ ਹੁੰਦੀ ਹੈ ਮੈਡਮ ਠੀਕ ਹੈ ਉਨ੍ਹਾਂ ਸਫ਼ਾਈ ਤੋ ਅੱਗੇ ਤੋਂ ਕਰ ਲਵਾਂਗੇ ਵੈਸੇ ਤਾਂ ਮੈਮ ਅਸੀਂ ਰੋਜ ਹੀ ਸਫ਼ਾਈ ਕਰਦੇ ਹਾਂ ਲੇਕਿਨ ਕਸਟਮਰ ਨੂੰ ਵੀ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਸਫ਼ਾਈ ਦਾ ਆਪਣੇ ਮਤਲਬ ਹਰ ਚੀਜ਼ ਦਾ ਹਾਂਜੀ ਠੀਕ ਹੈ ਮੈਮ ਅੱਗੇ ਤੋਂ ਨਹੀਂ ਹੋਵੇਗਾ ਸਫ਼ਾਈ ਰੱਖਾਂਗੇ ਤੁਸੀਂ ਆਇਓ ਕਸਟਮਰ ਅਸੀਂ ਮਾਫ਼ੀ ਚਾਹੁੰਦੇ ਹਾਂ ਤੁਸੀਂ ਸਾਨੂੰ ਜਿਹੜੀਆਂ ਇੰਨੀਆਂ ਪ੍ਰੋਬਲਮਸ ਜਾਂ ਖਾਣੇ 'ਚ ਕੋਈ ਵੀ ਦਿੱਕਤ ਤੁਹਾਨੂੰ ਨਜ਼ਰ ਆਈ ਹੈ ਤਾਂ ਕੋਈ ਗੱਲ ਨਹੀਂ ਅਸੀਂ ਅਗਾਂਹ ਤੋਂ ਸਹੀ ਕਰ ਲਵਾਂਗੇ ਸਫ਼ਾਈ ਰੱਖਾਂਗੇ ਇੱਕ ਅੱਧੇ ਇੱਕ ਨਹੀਂ ਨਹੀਂ ਸ ਮੈਡਮ ਅਸੀਂ ਮਾਫ਼ੀ ਚਾਹੁੰਦੇ ਹਾਂ ਮਤਲਬ ਅਸੀਂ ਤਾਂ ਸ਼ੋਪ 'ਚ ਹੁੰਦੇ ਨਹੀਂ ਜਿਹੜੇ ਰੱਖੇ ਹੋਏ ਹੈ ਬੰਦੇ ਉਹ ਹੁੰਦੇ ਆ ਉਨ੍ਹਾਂ ਨੂੰ ਹੁਣ ਖਿੱਚ ਕੇ ਰੱਖਾਂਗੇ ਉਨ੍ਹਾਂ ਨੂੰ ਕਹਾਂਗੇ ਸਫ਼ਾਈ ਰੱਖਿਆ ਕਰੋ ਤੁਸੀਂ ਹੋਰ ਵੀ ਜੇ ਕੋਈ ਦੱਸ ਸਕਦੇ ਹੋ ਹਾਂਜੀ ਹਾਂਜੀ ਮੈਡਮ ਅਸੀਂ ਦੇਖ ਲਵਾਂਗੇ ਕਿਹੜੇ ਕਿਹੜੇ ਕਸਟਮਰ ਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਉਹ ਚੀਜ਼ਾਂ ਜਿਵੇਂ ਤੁਸੀਂ ਸੋਇਆਬੀਨ ਰੈਫਰ ਕਰ ਰਹੇ ਹੋ ਆਪਾਂ ਉਨ੍ਹਾਂ ਨੂੰ ਚੀਜਾਂ ਨੂੰ ਹੀ ਲੈਂਦੇ ਹਾਂ ਵੀ ਕਸਟਮਰ ਅ ਸਾਡਾ ਮੇਨ ਮਕਸਦ ਹੀ ਕਸਟਮਰ ਨੂੰ ਖੁਸ਼ ਕਰਨਾ ਹੈ ਜੇ ਕਸਟਮਰ ਹੀ ਨਾ ਖੁਸ਼ ਹੋਏ ਤਾਂ ਫਿਰ ਫਾਇਦਾ ਹੀ ਕੀ ਹੈ ਠੀਕ ਹੈ ਓਕੇ